ਮੇਰਾ ਸਭ ਤੋਂ ਪਸੰਦੀਦਾ ਮੌਸਮ ਜੋ ਹੈ ਸਰਦੀਆਂ ਦਾ ਹੈ ਸਰਦੀਆਂ ਦੇ ਮੌਸਮ 'ਚ ਮਤਲਬ ਮਤਲਬ ਬੰਦਾ ਗਰਮੀ 'ਚ ਤਾਂ ਬੜੀ ਘਬਰਾਹਟ ਹੁੰਦੀ ਹੈ ਕੋਈ ਮਤਲਬ ਤਰੀਕਾ ਨਹੀਂ ਆ ਉਸ ਚੀਜ਼ ਨੂੰ ਦੂਰ ਕਰਨ ਦਾ ਨਾ ਏ ਸੀ ਲਾਉਣ ਤੋਂ ਬਾਅਦ ਸਾਰਾ ਦਿਨ ਅਸੀਂ ਏ ਸੀ 'ਚ ਵੀ ਨਹੀਂ ਬੈਠ ਸਕਦੇ ਪਰ ਸਰਦੀਆਂ 'ਚ ਅਸੀਂ ਕੱਪੜੇ ਪਾ ਸਕਦੇ ਹਾਂ ਉਸ ਚੀਜ਼ ਸਰਦੀ ਨੂੰ ਦੂਰ ਕਰਨ ਲਈ ਔਰ ਜਿੱਦਾਂ ਦਾ ਚਾਹੇ ਖਾ ਸਕਦੇ ਹਾਂ ਗਰਮ ਚੀਜ਼ਾਂ ਚਾਹੇ ਪਿੰਨੀਆਂ ਕੁਛ ਵੀ ਮਤਲਬ ਗਰਮੀ 'ਚ ਤਾਂ ਬੰਦਾ ਬਹੁਤ ਵਾਰ ਸੋਚਦਾ ਗਰਮੀ ਹੋ ਜਾਏਗੀ ਖਾ ਕੇ ਸਰਦੀ 'ਚ ਅਸੀਂ ਤਾਕਤ ਵਾਲੀਆਂ ਚੀਜ਼ਾਂ ਖਾ ਸਕਦੇ ਹਾਂ ਪਿੰਨੀਆਂ ਪੰਜੀਰੀ ਕੁਛ ਵੀ ਖਾ ਸਕਦੇ ਹਾਂ ਮਤਲਬ ਔਰ ਬਸ ਬੈਸਟ ਹੈ ਮਤਲਬ ਮੇਰੇ ਅਕੋਡਿੰਗ ਸਰਦੀਆਂ ਸਭ ਤੋਂ ਬੈਸਟ ਹੈ